ਮੈਂ ਆਪਦੇ ਈ ਕਮਰਸ ਐਪ ਦੀ ਵਰਤੋਂ ਕਰਦੀ ਹਾਂ ਜਦੋਂ ਮੈਨੂੰ ਕੋਈ ਚੀਜ਼ ਖਰੀਦਣੀ ਹੁੰਦੀ ਆ ਅਤੇ ਜਦੋਂ ਮੈਂ ਕੋਈ ਚੀਜ਼ ਖਰੀਦਦੀ ਹਾਂ ਉਦੋਂ ਮੈਂ ਮੇਨ ਇੱਕ ਪ੍ਰੋਸੈਸ ਹੁੰਦੀ ਹੈ ਜਿਵੇਂ ਕਿ ਮੈਂ ਰਿਸਰਚ ਕਰਦੀ ਹਾਂ ਕੰਪੈਰੀਜ਼ਨ ਕਰਦੀ ਹਾਂ ਅਤੇ ਡਿਸੀਜ਼ਨ ਮੇਕਿੰਆ ਸਟੈਪਸ ਲੈਂਦੀ ਹਾਂ ਕਿ ਮੈਨੂੰ ਕਿਵੇਂ ਦਾ ਪ੍ਰੋਡਕ ਅਤੇ ਕਿੱਦਾਂ ਦੇ ਡੀਲ 'ਚ ਚਾਹੀਦਾ ਹੈ ਉਵੇਂ ਦਾ ਪ੍ਰੋਟੈਕਟ ਦੇਖ ਕੇ ਫਿਰ ਮੈਂ ਸਟਾਰਟ ਕਰਦੀ ਹਾਂ ਜਿਵੇਂ ਕਿ ਪਹਿਲਾਂ ਮੈਂ ਰਿਸਰਚ ਕਰਦੀ ਹਾਂ ਕਿ ਮੈਨੂੰ ਕਿਹੜਾ ਪ੍ਰੋਡਕਟ ਕਿਹੜੀ ਕੰਪਨੀ ਦਾ ਚਾਹੀਦਾ ਹੈ ਅਤੇ ਕਿਹੜੇ ਗਾ ਬ੍ਰੈਂਡ ਦਾ ਚਾਹੀਦਾ ਉੱਦੂ ਬਾਅਦ ਮੈਂ ਸਾਈਜ ਕਲਰ ਉਹ ਸਭ ਕੁਝ ਦੇਖਦੀ ਹਾਂ ਰੇਟਿੰਗ ਦੇਖਦੀ ਹਾਂ ਰਿਵਿਊਜ ਦੇਖਦੀ ਹਾਂ ਕਸਟਮਰਸ ਦੇ ਕਿਹੜਾ ਬਰਾਂਡ ਵਧੀਆ ਹੈ ਨਹੀਂ ਹੈ ਉਹਦੇ ਰਿਵਿਊ ਪੋਜੀਟਿਵ ਨੈਗਟਿਵ ਰਿਵਿਊ ਚੈੱਕ ਕਰਦੀ ਹਾਂ ਪ੍ਰਾਈਜ ਕੰਪੈਰੀਜ਼ਨ ਕਰਦੀ ਹਾਂ ਅੱਡ ਬਰੈਂਡਸ ਨਾਲ ਜਿਹੜੇ ਬ੍ਰੈਂਡਸ ਦਾ ਵਧੀਆ ਮਿਲਦਾ ਫਿਰ ਮੈਂ ਉਹ ਬਾਏ ਕਰਦੀ ਹਾਂ ਆਲਸੋ ਉਹਨਾਂ ਦੀ ਇੱਕ ਰਿਟਨ ਪੋਲਿਸੀ ਵੀ ਚੈੱਕ ਕਰਦੀ ਹਾਂ ਕਿ ਅਗਰ ਇਹ ਫੋਰ ਡਿਫੈਕਟਿਵ ਨਿਕਲ ਜੇ ਤਾਂ ਮੈਂ ਉਹਨਾਂ ਨੂੰ ਰਿਟਨ ਕਰ ਸਕਦੀ ਹਾਂ ਫਿਰ ਫਾਈਨਲ ਡਸੀਜ਼ਨ ਲੈ ਕੇ ਮੈਂ ਉਹਦੀ ਟੋਟਲ ਕੋਸਟ ਪੇਮੈਂਟ ਕਰਦੀ ਹਾਂ ਅਤੇ ਸਮਟਾਈਮ ਮੈਂ ਕੈਸ਼ ਔਨ ਡਿਲੀਵਰੀ ਕਰਦੀ ਹਾਂ ਅਦਰਵਾਈਜ਼ ਸਮਟਾਈਮ ਮੈਂ ਆਨਲਾਈਨ ਪੇ ਕਰਦੀ ਹਾਂ ਔਰ ਸਮਟਾਈਮ ਮੈਂ ਕ੍ਰੈਡਿਟ ਕਾਰਡਸ ਨਾਲ ਪੇ ਕਰਦੀ ਹਾਂ ਮੈਂ ਕੁਝ ਕੁ ਟਿਪਸ ਦੇਣਾ ਚਾਹੁੰਦੀ ਹਾਂ ਫੌਰ ਨੈਵੀਗੇਟਿੰਗ ਈ ਕੌਮਰਸ ਐਪ ਲਈ ਕਿ ਅਸੀਂ ਜਦੋਂ ਵੀ ਈ ਕੌਮਰਸ ਐਪ ਦੇਖਦੇ ਹਾਂ ਉਹਦੇ ਵਿੱਚ ਹਮੇਸ਼ਾ ਕੁਛ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਅਸੀਂ ਦੇਖਣੀਆਂ ਚਾਹੀਦੀਆਂ ਜਿਵੇਂ ਕਿ ਕਈ ਚੀਜ਼ਾਂ ਹੁੰਦੀਆਂ ਆਪਾਂ ਨੂੰ ਪਸੰਦ ਆਉਂਦੀਆਂ ਅਸੀਂ ਬਾਅਦ ਵਿੱਚ ਲੈਣਾ ਚਾਹੁੰਦੇ ਹਾਂ ਤਾਂ ਅਸੀਂ ਉਹਨੂੰ ਸੇਵ ਕਰ ਸਕਦੇ ਹਾਂ ਕਿ ਅਸੀਂ ਬਾਅਦ ਵਿੱਚ ਉਹ ਟਰੈਕ ਕਰ ਸਕੀਏ ਅਦਰਵਾਈਜ਼ ਆਪਾਂ ਉਹਦੇ ਵਿੱਚ ਰਿਟਨ ਐਂਡ ਸ਼ਿਪਿੰਗ ਪੋਲਿਸੀ ਚੈੱਕ ਕਰ ਸਕਦੇ ਹਾਂ ਕਿ ਕੋਈ ਵੀ ਪ੍ਰੋਡਕਟ ਅਸੀਂ ਈਜ਼ੀਲੀ ਰਿਟਨ ਕਰ ਸਕੀਏ ਬਾਏ ਕਰ ਸਕੀਏ ਜਾਂ ਫਿਰ ਕਈਆਂ ਦੀ ਪ੍ਰਾਈਮ ਮੈਂਬਰਸ਼ਿਪ ਅਸੀਂ ਲੈ ਸਕੀਏ ਜਿਹਦੇ ਕਰਕੇ ਸਾਨੂੰ ਕਾਫੀ ਡੀਲਸ ਮਿਲਦੀਆਂ ਇਸ ਤਰੀਕੇ ਨਾਲ ਮੈਂ ਈ ਕਾਮਰਸ ਐਪ ਹਮੇਸ਼ਾ ਯੂਜ ਕਰਦੀ ਹਾਂ ਅਤੇ ਚੈੱਕ ਕਰਦੀ ਰਹਿੰਦੀ ਹਾਂ ਅਤੇ ਮੈਂ ਆਪਦੀਆਂ ਹਮੇਸ਼ਾ ਕਾਫੀ ਪ੍ਰੋਡਕਟਸ ਇੱਦਾਂ ਹੀ ਈ ਕੋਮਰਸ ਐਪ ਤੋਂ ਬਾਏ ਕਰਦੀ ਹਾਂ